ਮਰੂਤੀ ਸਜੂਕੀ ਹੋਂਡਾ ਸਿਟੀ ਡਿਜਾਇਰ ਸਵਿਫਟ ਸਕੋਰਪੀਓ ਇਨੋਵਾ ਇਨੋਵਾ ਕ੍ਰਿਸਟਾ ਕ੍ਰੇਟਾ ਐਕਸ ਯੂ ਵੀ ਸੈਵਨ ਹੰਡਰਡ ਕਰੂਜ਼ ਫੋ ਫੋਡ ਇਨਡੈਵਰ ਫੋਰਚੂਨਰ ਆਲਟੋ ਮਰੂਤੀ ਏਟ ਹੰਡਰਡ ਸੀਆਜ ਸੀਵਿਕ